ਮੈਂ ਬਹੁਤ ਟਾਈਮ ਤੋਂ ਔਨਲਾਈਨ ਵੈਬਸਾਈਟਾਂ ਦੇ ਉੱਪਰ ਜਾ ਕੇ ਸ਼ੋਪਿੰਗ ਕਰਦਾ ਰਹਿੰਦਾ ਬਹੁਤ ਵਧੀਆ ਸਾਈਟਾਂ ਵੀ ਹਨ ਅਤੇ ਬਹੁਤ ਖਰਾਬ ਪ੍ਰੋਡਕਟ ਭੇਜਣ ਵਾਲੀਆਂ ਸਾਈਟਾਂ ਵੀ ਪਿਛਲੇ ਕੁਝ ਦਿਨਾਂ ਵਿੱਚ ਮੈਂ ਆਪਣੇ ਰੋਜ਼ਾਨਾ ਪਾਉਣ ਵਾਲੇ ਬੂਟਾਂ ਦੀ ਸ਼ੋਪਿੰਗ ਕੀਤੀ ਸੀ ਜਿਸ ਵਿੱਚ ਮੈਂ ਮੰਤਰਾ ਤੋਂ ਇੱਕ ਸ਼ੂਜ ਔਡਰ ਕੀਤੇ ਸੀ ਜੋ ਕਿ ਫੋਟੋ ਵਿੱਚ ਦੇਖਣ ਨੂੰ ਤਾਂ ਬਹੁਤ ਹੀ ਸੁੰਦਰ ਅਤੇ ਮਜ਼ਬੂਤ ਨਜ਼ਰ ਆ ਰਹੇ ਸਨ ਪਰੰਤੂ ਉਹਨਾਂ ਨੂੰ ਜਦੋਂ ਮੈਂ ਔਡਰ ਕੀਤਾ ਤਾਂ ਉਹਨਾਂ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਘਟੀਆ ਅਤੇ ਭੱਦੀ ਬਣਾਵਟ ਮੈਨੂੰ ਪ੍ਰਾਪਤ ਹੋਈ ਰੇਟ ਦੇ ਹਿਸਾਬ ਨਾਲ ਵੀ ਉਹ ਬਹੁਤ ਜ਼ਿਆਦਾ ਮਹਿੰਗੇ ਲੱਗ ਰਹੇ ਸਨ ਪਰੰਤੂ ਮੈਨੂੰ ਸੂਜ਼ ਫੋਟੋ ਦੇਖਣ 'ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਲੱਗੇ ਪਰੰਤੂ ਜਦ ਮੇਰੇ ਕੋਲ ਮੈਨੂੰ ਪ੍ਰਾਪਤ ਹੋਏ ਤਾਂ ਉਹਨਾਂ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਘਟੀਆ ਨਜ਼ਰ ਆਈ